ਡਾਂਸ ਨਾਲ਼ ਆਪਸੀ ਭਾਈਚਾਰੇ ਦੀ ਭਾਵਨਾ ਇਸ ਤਰ੍ਹਾਂ ਵੱਧ ਸਕਦੀ ਹੈ ਕਿ ਜਿਵੇਂ ਕੋਈ ਗਰੁੱਪ ਵਿੱਚ ਡਾਂਸ ਕਰਦਾ ਹੈ ਤਾਂ ਉਹਨਾਂ ਆਪਸੀ ਲੋਕਾਂ ਵਿੱਚ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ ਇੱਕ ਦੂਜੇ ਦਾ ਸਨਮਾਨ ਕਰਦੇ ਹੋਏ ਇੱਕ ਦੂਜੇ ਨਾਲ਼ ਰਲ਼ ਕੇ ਡਾਂਸ ਕਰਦੇ ਹਨ ਤਾਂ ਜੋ ਉਹਨਾਂ ਦੀ ਪਰਫੋਰਮੈਂਸ ਵਧੀਆ ਹੋ ਸਕੇ ਨਾਲ਼ੇ ਇਸ ਦੇ ਨਾਲ਼ ਹੀ ਜੋ ਸੱਭਿਆਚਾਰਿਕ ਸਾਡੇ ਡਾਂਸ ਹੁੰਦੇ ਹਨ ਜਿਵੇਂ ਭੰਗੜਾ ਗਿੱਧਾ ਅਤੇ ਇਸ ਤਰੀਕੇ ਦੇ ਡਾਂਸ ਕਰਨ ਨਾਲ਼ ਜੋ ਸਾਡੇ ਸੱਭਿਆਚਾਰ ਨਾਲ਼ ਜੁੜੇ ਹੋਏ ਲੋਕ ਨੇ ਉਹ ਵੀ ਸਾਡੇ ਨਾਲ਼ ਜੁੜ ਜਾਂਦੇ ਹਨ ਇਸ ਤਰ੍ਹਾਂ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਤੋਂ ਇਲਾਵਾ ਡਾਂਸ ਦੀ ਕੋਈ ਜਾਤੀ ਅਤੇ ਧਰਮ ਨਹੀਂ ਹੁੰਦਾ ਡਾਂਸ ਇੱਕ ਇੱਕ ਡਾਂਸ ਦੇ ਤਰੀਕੇ ਨਾਲ਼ ਲਿਆ ਜਾਂਦਾ ਹੈ ਤਾਂ ਕਿ ਜੋ ਦੂਜਾ ਲੋਕ ਡਾਂਸ ਕਰਨ ਵਾਲੇ ਆਦਮੀ ਨੂੰ ਦੇਖ ਰਿਹਾ ਹੈ ਅਤੇ ਉਹ ਉਸਦੇ ਡਾਂਸ ਤੋਂ ਪ੍ਰਭਾਵਿਤ ਹੋ ਕੇ ਉਸ ਤੋਂ ਮੋਟੀਵੇਟ ਹੁੰਦਾ ਹੈ ਅਤੇ ਆਪ ਵੀ ਡਾਂਸ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਇਸ ਤਰ੍ਹਾਂ ਦੋਨਾਂ ਵਿੱਚ ਭਾਈਚਾਰੇ ਦੀ ਭਾਵਨਾ ਇੱਕ ਪੈਦਾ ਹੋ ਜਾਂਦੀ ਹੈ ਤਾਂ ਜੋ ਉਹ ਆਪਸ ਵਿੱਚ ਰਲ਼ ਕੇ ਇੱਕ ਦੂਜੇ ਦੀ ਸਹਾਇਤਾ ਕਰਦੇ ਹੋਏ ਇੱਕ ਦੂਜੇ ਨੂੰ ਸਿਖਾਉਂਦੇ ਹੋਏ ਡਾਂਸ ਕਰ ਸਕਣ ਅਤੇ ਉਸਦੇ ਲਈ ਅਗਲੇ ਆਪਣੇ ਆਪ ਨੂੰ ਹੋਰ ਜ਼ਿਆਦਾ ਵਧੀਆ ਤਰਾਸ਼ਣ ਲਈ ਡਾਂਸ ਵਿੱਚ ਅੱਗੇ ਵਧਣ ਲਈ ਆਪਣੇ ਆਪ ਨੂੰ ਇੱਕ ਤਰੀਕਾ ਦੇ ਸਕਣ